ਫਿਲਮ ਖੇਤਰ ਦੇ ਵਿੱਚ ਜਿਵੇਂ ਕਿ ਅਮਿਤਾਬ ਬੱਚਨ ਹੈ ਨੱਬੇ ਦੇ ਦਸ਼ਕ ਦੇ ਵਿੱਚ ਬਹੁਤ ਫਿਲਮਾਂ ਕੀਤੀਆਂ ਉਹਨਾਂ ਨੇ ਔਰ ਉਨ੍ਹਾਂ ਦੇ ਨਾਲ ਨਾਲ ਲੋਕ ਫਿਲਮਾਂ ਨੂੰ ਦੇਖਣ ਦੇ ਰੁਝਾਨ ਦੇ ਵਿੱਚ ਪਹਿਰਾਵਾ ਬਹੁਤ ਪਸੰਦ ਕਰਦੇ ਸੀ ਜਿਸ ਦੇ ਵਿੱਚ ਉਨ੍ਹਾਂ ਦੀ ਜੋ ਬੈੱਲਬਲੋਟਮ ਹੈ ਪੈਂਟ ਹੈ ਉਹਨੂੰ ਅੱਜ ਵੀ ਪਸੰਦ ਕਰਦੇ ਹਨ ਔਰ ਉਸਦਾ ਲੋਕਾਂ ਦੇ ਵਿੱਚ ਵੀ ਬਹੁਤ ਰੁਝਾਨ ਹੋਇਆ